ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਵਾਂਗੀ ਕਿ ਪੇਂਟਿੰਗ ਮੇਰੀ ਇਕ ਬਹੁਤ ਵੱਡੀ ਹੋਬੀ ਹੈ ਜਿਸਨੂੰ ਮੈਂ ਸਕੂਲ ਟਾਈਮ ਤੋਂ ਹੀ ਕਰ ਰਹੀ ਹਾਂ ਅਤੇ ਹੁਣ ਮੈਂ ਆਪਣੀ ਕਾਲਜ ਲਾਈਵ ਵਿੱਚ ਵੀ ਉਸਨੂੰ ਕੰਟੀਨਿਊ ਕਰਕੇ ਰੱਖਿਆ ਹੋਇਆ ਹੈ ਸਕੂਲ ਟਾਈਮ ਵਿੱਚ ਮੈਨੂੰ ਯਾਦ ਹੈ ਕਿ ਮੈਂ ਪਲਸ ਟੂ ਵਿੱਚ ਇੱਕ ਕੰਪੀਟੀਸ਼ਨ ਵਿੱਚ ਭਾਗ ਲਿਆ ਸੀ ਜਿਸ ਵਿੱਚ ਮੈਨੂੰ ਫਸਟ ਪੋਜੀਸ਼ਨ ਹਾਸਿਲ ਹੋਈ ਸੀ ਉਸ ਪੇਂਟਿੰਗ ਵਿੱਚ ਮੈਂ ਚਾਰ ਪੰਜ ਪਾਰਟਸ ਬਣਾਏ ਹੋਏ ਸੀਗੇ ਜਿਸ ਵਿੱਚ ਉਹ ਹਰ ਇੱਕ ਪਾਰਟ ਅਲੱਗ ਅਲੱਗ ਫੀਲਿੰਗ ਨੂੰ ਦਰਸਾ ਰਿਹਾ ਸੀ ਜਿਵੇਂ ਕਿ ਖੁਸ਼ੀ ਨੂੰ ਗਮੀ ਨੂੰ ਕਿ ਆਪਾਂ ਪਾਣੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਬੇਟੀ ਬਚਾਓ ਬਜਾਓ ਕਿਸ ਤਰ੍ਹਾਂ ਕਰਨਾ ਹੈ ਪਰ ਮੈਂ ਹਮੇਸ਼ਾ ਆਪਣੀ ਪੇਂਟਿੰਗ ਵਿੱਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਸੀ ਪਰ ਸਾਰੇ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਸੀ ਕਿਸੇ ਨੂੰ ਉਹ ਸਿਰਫ ਇੱਕ ਸਧਾਰਨ ਪੇਂਟਿੰਗ ਲ ਪੇਂਟਿੰਗ ਹੀ ਲੱਗਦੀ ਸੀ ਕਿ ਹਾਂ ਬਸ ਬੱਚੇ ਨੂੰ ਡਰਾ ਕਰਕੇ ਰੱਖਿਆ ਹੋਇਆ ਕੁਛ ਕਿਸੇ ਨੂੰ ਉਹ ਕੰਪਲੀਕੇਟਡ ਲੱਗਦੀ ਸੀ ਤਾਂ ਕੋਈ ਕੋਈ ਉਸਨੂੰ ਸਮਝ ਵੀ ਲੈਂਦਾ ਸੀਗਾ ਕਿ ਹਾਂ ਇਹ ਅਗਰ ਇਹ ਪੇਂਟਿੰਗ ਬਣਾਈ ਗਈ ਹੈ ਤਾਂ ਇਸ ਨੂੰ ਬਣਾਉਣ ਦਾ ਕੋਈ ਮਕਸਦ ਹੈ ਅਤੇ ਕੋਈ ਸਿਰਫ ਇਸ ਨੂੰ ਡਰਾਇੰਗ ਹੀ ਡਰਾਇੰਗ ਹੀ ਸਮਝਦਾ ਸੀ ਪਰ ਜਿਹੜੇ ਮੇਰੇ ਨਾਲ ਮੇਰੇ ਫਰੈਂਡ ਜੋ ਮੇਰੇ ਨਾਲ ਪੜ੍ਹਦੇ ਸੀ ਜਾਂ ਮੇਰੇ ਨਾਲ ਜੋ ਪੇਂਟਿੰਗ ਕਰਦੇ ਸੀ ਜਿਹਨਾਂ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਸੀ ਉਹ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਲੈਂਦੇ ਸਨ ਕਿ ਹਾਂ ਇਸ ਨਾਲ ਮੈਂ ਮੇਰੀਆਂ ਭਾਵਨਾਵਾਂ ਜੁੜੀਆਂ ਹਨ ਜਾਂ ਮੈਂ ਇਸ ਵਿੱਚ ਆਪਣੀ ਕਿਹੜੀ ਫੀਲਿੰਗ ਨੂੰ ਸ਼ੋ ਕੀਤਾ ਹੈ